ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਜੋ ਵੀ ਸੰਸਥਾਵਾਂ ਹਨ ਉਹਨਾਂ ਬਾਰੇ ਸਾਨੂੰ ਮੈਨੂੰ ਤਾਂ ਨੀ ਕੋਈ ਨੋਲੇਜ ਹੈਗੀ ਗੀ ਪਰ ਕਦੇ ਇਸ ਕੰਮ ਦੇ ਵਿੱਚ ਪਏ ਨੇ ਤਾਂ ਕਰਕੇ ਉਹਦੇ ਬਾਰੇ ਕੋਈ ਨੋਲੇਜ ਨਹੀਂ ਹੈ ਤਸਵੀਰਕਾਰੀ ਕਾਰਨ ਦੀ ਵੀ ਨੋਲੇਜ ਹੈ ਪਰ ਇਹਨਾਂ ਬਾਰੇ ਜੋ ਸੰਸਥਾਵਾਂ ਫੋਟੋਗਰਾਫੀ ਡਿਗਰੀ ਦਿੰਦੀਆਂ ਨੇ ਉਹਨਾਂ ਬਾਰੇ ਕੋਈ ਨੌਲੇਜ ਨਹੀਂ ਹੈ ਤੇ ਬਾਕੀ ਜੋ ਸਾਡੀਆਂ

ਕੋਈ ਚੈਨਲ ਨੇਗੇ ਜੋ ਫੋਟੋਗਰਾਫੀ ਤਸਵੀਰ ਕਾਰੀਆਂ ਕਰਦੇ ਨੇ ਜਿਹਨਾ ਦਾ ਯੂਟੀਊਬ ਵਗੈਰਾ ਤੇ ਪ੍ਰਦਰਸ਼ਨੀ ਹੁੰਦੀ ਆ ਐਗਜੀਬੀਸ਼ਨ ਲੱਗਦੀਆਂ ਨੇ ਇਥੇ ਪੰਜਾਬ ਦੇ ਵਿੱਚ ਤਸਵੀਰਕਾਰੀਆਂ ਦੀਆਂ ਪੰਜਾਬ ਪੱਧਰ ਤੇ ਜੋ ਤਸਵੀਰਕਾਰੀਆਂ ਦੇ ਐਗਜੀਬੀਸ਼ਨ ਪ੍ਰਦਰਸ਼ਨੀਆ ਲੱਗਦੀਆਂ ਨੇ ਉਹ ਜਰੂਰ ਦੇਖ ਆਉਨੇ ਆ ਪਰ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਜਿਹੜੀਆਂ ਸੰਸਥਾਵਾਂ ਨੇ ਫੋਟੋਗ੍ਰਾਫੀ ਦੀ ਡਿਗਰੀ ਦੇਣ ਦੀਆਂ ਉਹਨਾਂ ਬਾਰੇ ਕੋਈ ਨੌਲੇਜ ਨਹੀਂ ਹੈ ਹੁਣ ਤੁਹਾਡੇ ਇਸ ਮਾਧਿਆਮ ਜਰੂਰ ਕੋਸ਼ਿਸ਼ ਕਰਾਂਗੇ ਤੇ ਕਿਸੇ ਵੀ ਸੰਸਥਾ ਜੋ ਫੋਟੋਗ੍ਰਾਫੀ ਦੀ ਡਿਗਰੀ ਦਿੰਦੀਆਂ ਉਹਨਾ ਬਾਰੇ ਜਾਣਕਾਰੀ ਲਈ ਜਾ ਸਕੇ ਧੰਨਵਾਦ ਆ ਤੁਹਾਡਾ ਜੋ ਇਨਾ ਮਤਲਬ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ